ਹਾਂਜੀ ਪੰਜਾਬ ਦੇ ਵਿੱਚ ਨਾ ਜਿਹੜੇ ਜਿਹੜੇ ਕਲਾ ਸਕੂਲ ਹੈਗੇ ਹੈ ਇਹ ਇੱਕ ਤਾਂ ਇੱਥੇ ਮੁਕਤਸਰ ਹੈਗਾ ਆਈ ਟੀ ਆਈ ਦੇ ਵਿੱਚ ਮੈਂ ਖੁਦ ਆਪ ਕੀਤਾ ਵੀ ਸਿਲਾਈ ਦਾ ਕੋਰਸ ਕੀਤਾ ਅਤੇ ਕਢਾਈ ਦਾ ਕੀਤਾ ਅਤੇ ਤੀਜਾ ਮੈਂ ਨੀਟਿੰਗ ਵਿਦ ਹੈਂਡ ਐਂਡ ਮਸ਼ੀਨ ਦਾ ਕੀਤਾ ਅਤੇ ਨੈਕਸਟਟਾਈਨ ਹੈਗਾ ਆਈ ਟੀ ਆਈ ਹੈਗੀ ਹੈ ਅਤੇ ਉੱਥੇ ਵੀ ਸਿਲਾਈ ਕਢਾਈ ਦਾ ਕਰਵਾਇਆ ਜਾਂਦਾ ਅਤੇ ਪਾਰਲਰ ਦਾ ਕਰਵਾਇਆ ਜਾਂਦਾ ਅਤੇ ਕੰਪਿਊਟਰ ਦਾ ਵੀ ਕੋਰਸ ਕਰਵਾਇਆ ਜਾਂਦਾ ਹੈ ਫੋਟੋਗ੍ਰਾਫੀ ਦਾ ਵੀ ਮੁੰਡਿਆਂ ਵਾਸਤੇ ਕਰਵਾਇਆ ਜਾਂਦਾ ਹੈ ਅਤੇ ਕੁੜੀਆਂ ਵਾਸਤੇ ਹੋ ਗਿਆ ਫੈਸ਼ਨ ਡਿਜ਼ਾਈਨਿੰਗ ਦਾ ਹੈਗਾ ਅਤੇ ਪੇਂਟਿੰਗ ਦਾ ਹੋ ਗਿਆ ਆਪਣਾ ਹੈਂਡ ਵਰਕ ਹੋ ਗਿਆ ਅਤੇ ਆਰੀ ਦਾ ਵਰਕ ਇਹ ਸਾਰਾ ਫਲਾਵਰ ਮੇਕਰ ਹੁੰਦਾ ਵੀ ਕਰਵਾਇਆ ਜਾਂਦਾ ਇੱਥੇ ਸਾਨੂੰ ਅਤੇ ਮੁਕਤਸਰ ਹੈਗਾ ਸਰਾਏ ਨਾਗਾ ਹੈਗਾ ਖਿਓ ਵਾਲੀ ਹੈ ਗੁਰੂ ਨਾਨਕ ਕੋਲਜ ਹੈ ਬਾਦਲ ਪਿੰਡ ਹੈ ਅਤੇ ਰੈਡ ਕ੍ਰੋਸ ਵੱਲੋਂ ਵੀ ਸਾਨੂੰ ਇਹ ਸਾਰੇ ਬਹੁਤ ਸਾਰੇ ਕੋਰਸ ਆ ਜਿਹੜੇ ਉਹ ਸਾਰੇ ਕਰਵਾਏ ਜਾਂਦੇ ਹੈ ਅਤੇ ਇਹ ਕਰਕੇ ਅਸੀਂ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪਣਾ ਵਧੀਆ ਇੰਡੀਪੈਂਡੈਂਟ ਬਣ ਸਕਦੇ ਹਾਂ ਅਤੇ ਇਹਦਾ ਸਾਨੂੰ ਇਹ ਸਰਕਾਰ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਉਹਦੇ ਉਹਦਾ ਸਾਨੂੰ ਬਹੁਤ ਫ਼ਾਇਦਾ ਹੁੰਦਾ ਰੈਡ ਕ੍ਰੋਸ ਵੱਲੋਂ ਤਾਂ ਸਾਰੇ ਖਰਚਾ ਵੀ ਬਹੁਤ ਘੱਟ ਹੁੰਦਾ ਹੈ

ਫ਼ਾਇਦਾ ਲੈ ਕੇ ਅਤੇ ਵੀ ਜ਼ਿੰਦਗੀ ਦੇ ਰਸਤੇ ਵਿੱਚ ਅੱਗੇ ਚੱਲ ਸਕਦੇ ਹਾਂ ਪਰਿਵਾਰ ਪਾਲ ਸਕਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੀ ਧੰਨਵਾਦ ਜੀ